ਖੇਤੀਬਾੜੀ ਵਾਸਤੇ ਜਾਂ ਮੱਛੀ ਪਾਲਣ ਜਾਂ ਪਸ਼ੂ ਪਾਲਣ ਵਾਸਤੇ ਡੇਅਰੀਆਂ ਅੱਜ ਕੱਲ੍ਹ ਤਾਂ ਬਹੁਤ ਨੇ ਪਰ ਹੁਣ ਅੱਜ ਦੀ ਟੈਕਨੋਲੋਜੀ ਦੇ ਹਿਸਾਬ ਨਾਲ ਮਸ਼ੀਨਾਂ ਵੀ ਬਹੁਤ ਜ਼ਿਆਦਾ ਬਣ ਚੁੱਕੀਆਂ ਨੇ ਮਸ਼ੀਨਾਂ ਦੇ ਨਾਲ ਇਹ ਹਰ ਇਨਸਾਨ ਕੰਮ ਕਰਨਾ ਪਸੰਦ ਕਰਦਾ ਹੈ ਖੇਤੀ ਵੀ ਹੈ ਖੇਤੀ ਵਾਸਤੇ ਟਰੈਕਟਰ ਆ ਗਏ ਨੇ ਹੋਰ ਮਸ਼ੀਨਾਂ ਆ ਗਈਆਂ ਨੇ ਜੇ ਖੇਤੀ ਨੂੰ ਪਾਣੀ ਦੇਣਾ ਹੈ ਅਤੇ ਉਹ ਵੀ ਮਸ਼ੀਨਾਂ ਆ ਗਈਆਂ ਨੇ ਕਿ ਖੇਤੀ ਨੂੰ ਪਾਣੀ ਵੀ ਆਪਣੇ ਆਪ ਦਿੱਤਾ ਜਾਵੇ ਕੋਈ ਵੀ ਕੰਮ ਹੈ ਅੱਜ ਅੱਜ ਦਾ ਯੁੱਗ ਹੀ ਇਹੋ ਜਿਹਾ ਕੀ ਮਸ਼ੀਨਾਂ ਬਿਨਾਂ ਨਹੀਂ ਕੋਈ ਤੁਰਦਾ ਹੁਣ ਤਾਂ ਡੇਅਰੀਆਂ ਵਾਲੇ ਵੀ ਲੈ ਲਉ ਉਹਨਾਂ ਨੇ ਵੀ ਕੈਂਡੀਆਂ ਰੱਖੀਆਂ ਨੇ ਫ੍ਰਿਜ ਰੱਖੇ ਨੇ ਕਈ ਇਹੋ ਜਿਹੀਆਂ ਸਹੂਲਤਾਂ ਰੱਖੀਆਂ ਨੇ ਜਿਹਦੇ ਨਾਲ ਦੁੱਧ ਦਹੀਂ ਕ ਖਰਾਬ ਨਾ ਹੋਵੇ ਕਿ ਦੁੱਧ ਨੂੰ ਵੀ ਜ਼ਿਆਦਾ ਟਾਈਮ ਤੱਕਰ ਰੱਖਿਆ ਜਾਵੇ ਦਹੀਂ ਨੂੰ ਵੀ ਜ਼ਿਆਦਾ ਟਾਈਮ ਤੱਕਰ ਰੱਖਿਆ ਜਾਵੇ ਕਿ ਤਾਂ ਕਿ ਦਹੀਂ ਵੀ ਖੱਟਾ ਨਾ ਹੋਵੇ ਗਰਮੀ ਹੋਵੇ ਸਰਦੀ ਹੋਵੇ ਮਸ਼ੀਨਾਂ ਦੇ ਦੌਰਾਨ ਅਗਰ ਜੇ ਵਰਤੋਂ ਕੀਤੀ ਜਾਂਦੀ ਹੈ ਤਾਂ ਚੀਜ਼ਾਂ ਸਹੀ ਰਹਿ ਜਾਂਦੀਆਂ ਨੇ ਜੇ ਪਹਿਲੇ ਸਮੇਂ ਦੀ ਗੱਲ ਹੋਰ ਸੀ ਮਸ਼ੀਨਾਂ ਇੰਨੀਆਂ ਨਹੀਂ ਸੀ ਸਹੂਲਤਾਂ ਇੰਨੀਆਂ ਨਹੀਂ ਸੀ ਅਤੇ ਨੁਕਸਾਨ ਵੀ ਹੁੰਦਾ ਸੀ ਹੁਣ ਮਸ਼ੀਨਾਂ ਜ਼ਰੂਰ ਮਹਿੰਗੀਆਂ ਨੇ ਪੈਸਾ ਬਹੁਤ ਲੱਗਦਾ ਪਰ ਹਰ ਇਨਸਾਨ ਵਾਸਤੇ ਮਸ਼ੀਨਾਂ ਨੇ ਸਹੂਲਤ ਬਹੁਤ ਬਣਾ ਤੀ ਹੈ ਇਨਸਾਨਾਂ ਦੀ ਮਿਹਨਤ ਘੱਟ ਤਾਂ ਮਸ਼ੀਨਾਂ ਦੀ ਜ਼ਿਆਦਾ ਲੱਗਣ ਲੱਗ ਪਈ ਅੱਜ ਦਾ ਯੁੱਗ ਹੀ ਮਸ਼ੀਨਾਂ ਦੇ ਨਾਲ ਚੱਲਣ ਲੱਗ ਪਿਆ ਖੇਤੀ ਹੋ ਗਈ ਕੋਈ ਦਹੀਂ ਦੁੱਧ ਹੋ ਗਿਆ ਜਾਂ ਕਈ ਤਰ੍ਹਾਂ ਦੀਆਂ ਚੀਜ਼ਾਂ ਨੇ ਕੋਈ ਮੰਨ ਲਓ ਰਸੋਈ ਦੇ ਵਿੱਚ ਵੀ ਕੋਈ ਚੀਜ਼ਾਂ ਮਸ਼ੀਨਾਂ ਬਿਨਾਂ ਮਿਕਸੀ ਹੈ ਜਾਂ ਗਰੈਂਡਰ ਹੈ ਜਾਂ ਕੁਛ ਵੀ ਹੈ ਇਹ ਵੀ ਮਸ਼ੀਨਾਂ ਦੇ ਰਸੋਈ ਵੀ ਮਸ਼ੀਨਾਂ ਦੇ ਨਾਲ ਹੀ ਚੱਲਦੀ ਹੈ ਕੋਈ ਕੱਪੜੇ ਧੋਣ ਵਾਲੀ ਮਸ਼ੀਨ ਲੈ ਲਉ ਕੋਈ ਵੀ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਸਹੂਲਤਾਂ ਸਾਨੂੰ ਸਰਕਾਰ ਨੇ ਜਾਂ ਵਿਗਿਆਨਿਕ ਨੇ ਦਿੱਤੀਆਂ ਨੇ ਵਿਗਿਆਨ ਦਾ ਯੁੱਗ ਹੈ ਅਤੇ ਵਿਗਿਆਨ ਨਾਲ ਹੀ ਚੱਲ ਰਿਹਾ